ਹਾਂਜੀ ਅਸੀਂ ਇੱਕਰਾਰਨਾਮੇ ਬਾਰੇ ਮਾੜਾ ਮੋਟਾ ਤਾਂ ਜਾਣਦੇ ਹਾਂ ਪਰ ਸਾਨੂੰ ਇੰਨਾਂ ਕੁਝ ਪਤਾ ਹੈ ਨਹੀਂ ਗਾ ਕਿ ਇੱਕਰਾਰਨਾਮਾ ਕਿੱਦਾਂ ਹੁੰਦਾ ਇੱਥੇ ਰੋਜ਼ ਹੀ ਕਈ ਤਰ੍ਹਾਂ ਦੇ ਇੱਕਰਾਰਨਾਮੇ ਚੱਲਦੇ ਹਨ ਅਤੇ ਬਾਅਦ 'ਚ ਆਪਣੇ ਆਪ ਹੀ ਟੁੱਟ ਜਾਂਦੇ ਹਨ ਪੰਜਾਬ ਵਿੱਚ ਤਾਂ ਇੱਦਾਂ ਹੀ ਚੱਲਦਾ ਹੈ ਸਭ ਕੁਛ ਉੱਪਰ ਥੱਲੇ ਹੋ ਰੱਖਿਆ ਕੋਈ ਸਿਰ ਪੈਰ ਨਹੀਂ ਹੈਗਾ ਇੱਕਰਾਰਨਾਮਾ ਪਤਾ ਨਹੀਂ ਕਿਆ ਡਰਾਫਟਿੰਗ ਸਿਗਨੇਚਰ ਇਨਫੋਰਸਮੈਂਟ ਇਨਫੋਰਸਮੈਂਟ ਤਾਂ ਇੱਥੇ ਬਿਲਕੁਲ ਵੀ ਜ਼ੀਰੋ ਜ਼ੀਰੋ ਹੈਗੀ ਹੈ ਜੇ ਜਦੋਂ ਤੱਕ ਉਤੋਂ ਡੰਡਾ ਨਾ ਆਵੇ ਤਦ ਤੱਕ ਇਹਨਾਂ ਨੇ ਕੁਝ ਕੰਮ ਕਰਨਾ ਹੈ ਨਹੀਂ ਗਾ ਗਰਾਊਂਡ ਲੈਵਲ ਦੇ ਉੱਤੇ ਸਿਰਫ਼ ਪਿੰਡਾਂ ਦੇ ਵਿੱਚ ਸਰਪੰਚ ਹੀ ਕੰਮ ਕਰ ਰਹੇ ਹੈ ਸਰਪੰਚ ਦੇ ਨਾਲ ਨਾਲ ਲੋਕ ਜੁੜਦੇ ਆ ਤਾਂ ਹੀ ਕੰਮ ਹੁੰਦਾ ਸਰਕਾਰਾਂ ਨੂੰ ਤਾਂ ਕੋਈ ਹੈ ਨਹੀਂ ਕਿ ਵੀ ਇੱਕ ਲੋਕਾਂ ਲਈ ਕਿਆ ਭਲਾਈ ਦੀ ਸੇਵਾ ਜਾਂ ਕੁਛ ਕੁਛ ਨਹੀਂ ਹੈਗਾ ਜਿਹੜਾ ਸਰਕਾਰ ਕਰਨਾ ਚਾਹੁੰਦੀ ਵੀ ਹੈ ਲੋਕਾਂ ਲੋਕਾਂ ਕਰਕੇ ਲੋਕਾਂ ਉਹਨਾਂ ਨੂੰ ਕਰਨ ਨਹੀਂ ਦਿੰਦੇ ਇਸ ਕਰਕੇ ਅਸੀਂ ਇੱਕਰਾਰਨਾਮਾ ਦੇ ਉੱਤੇ ਸਾਨੂੰ ਕੁਝ ਪਤਾ ਨਹੀਂ ਹੈ ਹਾਂਜੀ ਧੰਨਵਾਦ ਜੀ ਵੈਰੀ ਗੁੱਡ